ਪੁਰਾਤਨ ਸਮੇਂ ਨਾਲੋਂ ਅੱਜ ਕੱਲ੍ਹ ਦੀ ਰਸੋਈ ਵਿੱਚ ਦਾ ਤਜ਼ਰਬਾ ਬਹੁਤ ਹੀ ਵੱਖਰਾ ਹੈ ਜਿਵੇਂ ਕਿ ਅਸੀਂ ਜਦੋਂ ਵੀ ਪੁਰਾਣੇ ਸਮੇਂ ਵਿੱਚ ਕੁਛ ਵੀ ਗ੍ਰਾਇੰਡ ਕਰਨਾ ਹੁੰਦਾ ਸੀ ਗੰਡੇ ਟਮਾਟਰ ਵਗੈਰਾ ਵਗੈਰਾ ਕੁਛ ਵੀ ਮਸਾਲਾ ਬਣਾਉਣਾ ਹੁੰਦਾ ਸੀਗਾ ਤਾਂ ਅਸੀਂ ਚੱਠੂ ਅਤੇ ਮੂੰਗਲੀ ਦੀ ਵਰਤੋਂ ਕਰਦੇ ਹੁੰਦੇ ਸੀ ਚੱਠੂ ਜਿਹੜਾ ਪੱਥਰ ਦਾ ਬਣਿਆ ਹੁੰਦਾ ਸੀ ਅਤੇ ਮੂੰਗਲੀ ਜਿਹੜੀ ਹੁੰਦੀ ਸੀ ਲੱਕੜ ਦੀ ਬਣੀ ਹੁੰਦੀ ਸੀਗੀ ਅਤੇ ਚੱਠੂ ਦੇ ਵਿੱਚ ਆਪਾਂ ਉਹਨੂੰ ਜਗ੍ਹਾ ਹੁੰਦੀ ਸੀਗੀ ਜਿਹਦੇ ਵਿੱਚ ਅਸੀਂ ਕੁਝ ਵੀ ਸਮਾਨ ਆਪਣਾ ਜੋ ਵੀ ਅਸੀਂ ਗ੍ਰਾਇੰਡ ਕਰਨਾ ਚਾਹੁੰਦੇ ਉਹ ਪਾ ਲਈਦਾ ਸੀਗਾ ਅਤੇ ਉਸ ਨੂੰ ਅਸੀਂ ਡੰਡੇ ਦੇ ਨਾਲ ਕੁੱਟ ਕੁੱਟ ਕੇ ਅਸੀਂ ਉਹਨੂੰ ਗ੍ਰਾਇੰਡ ਕਰੀਦਾ ਹੁੰਦਾ ਸੀ ਅਤੇ ਮਿਕਸ ਕਰੀਦਾ ਹੁੰਦਾ ਸੀ ਬਾਕੀ ਅੱਜ ਕੱਲ੍ਹ ਦੇ ਸਮੇਂ ਵਿੱਚ ਉਸ ਦੀ ਜਗ੍ਹਾ ਗ੍ਰਾਇੰਡਰ ਨੇ ਲੇ ਲੈ ਲਈ ਹੈ ਅਤੇ ਗ੍ਰਾਇੰਡਰ ਦੇ ਨਾਲ ਅਸੀਂ ਜਦੋਂ ਉਹਨਾਂ ਵਿੱਚ ਸਮਾਨ ਪਾਉਂਦੇ ਹਾਂ ਅਤੇ ਬਿਜਲੀ ਨੂੰ ਬਿਜਲੀ ਸਪਲਾਈ ਦੇ ਕੇ ਉਹਦਾ ਸਵਿੱਚ ਆਨ ਕਰਦੇ ਹਾਂ ਤਾਂ ਕੁਝ ਕੁ ਮਿੰਟਾਂ 'ਚ ਸਾਰਾ ਕੰਮ ਕਰ ਦਿੰਦਾ ਹੈ ਸਾਨੂੰ ਅ ਸਾਨੂੰ ਹੋਰ ਕੁਝ ਵੀ ਨਹੀਂ ਕਰਨਾ ਪੈਂਦਾ ਸਿਰਫ ਸੁਚ ਦੱਬ ਕੇ ਸਾਰਾ ਸ ਸਮਾਨ ਗ੍ਰਾਇੰਡ ਹੋ ਜਾਂਦਾ ਹੈ ਜਦਕਿ ਪੁਰਾਣੇ ਸਮੇਂ ਵਿੱਚ ਇੱਕ ਚੀਜ਼ ਨੂੰ ਗ੍ਰਾਇੰਡ ਕਰਨ ਲੱਗਿਆਂ ਪੰਦਰਾਂ ਪੰਦਰਾਂ ਵੀਹ ਵੀਹ ਮਿੰਟ ਅੱਧਾ ਅੱਧਾ ਘੰਟਾ ਲੱਗ ਜਾਂਦਾ ਹੁੰਦਾ ਸੀਗਾ ਅਤੇ ਹੱਥ ਵੀ ਰਹਿ ਜਾਂਦੇ ਹੁੰਦੇ ਸੀ ਉਹਨਾਂ ਨੂੰ ਗ੍ਰਾਇੰਡ ਕਰਦਿਆਂ ਕਰਦਿਆਂ ਅਤੇ ਦੂਜੇ ਪਾਸੇ ਅੱਜ ਕੱਲ੍ਹ ਗੈਸ ਸਿਲੰਡਰ ਦੀ ਵਰਤੋਂ ਬਹੁਤ ਹੋ ਰਹੀ ਹੈ ਗੈਸ ਪੁਰਾਣੇ ਸਮੇਂ ਵਿੱਚ ਇਹ ਗੈਸ ਸਿਲੰਡਰ ਵਗੈਰਾ ਵੀ ਕੁਛ ਨਹੀਂ ਹੁੰਦੇ ਸੀਗੇ ਪਲਾਂਟ ਗੈਸ ਸਿਲੰਡਰ ਦੀ ਜਗ੍ਹਾ ਪੁਰਾਣੇ ਸਮੇਂ ਵਿੱਚ ਲੱਕੜੀ ਦਾ ਬਾਲਣ ਅਤੇ ਪਾਥੀਆਂ ਦਾ ਬਾਲਣ ਵਰਤਿਆ ਜਾਂਦਾ ਸੀਗਾ ਲੱਕੜੀ ਦਾ ਬਾਲਣ ਵਰਤਣ ਲਈ ਤਾਂ ਸਭ ਤੋਂ ਪਹਿਲਾਂ ਲੋਕ ਪੁਰਾਣੇ ਲੋਕ ਲੱਕੜੀ ਨੂੰ ਇਕੱਠੀ ਕਰਦੇ ਹੁੰਦੇ ਸੀਗੇ ਟੁੱਟੀਆਂ ਲੱਕੜੀਆਂ ਜਾਂ ਲੱਕੜੀਆਂ ਵੱਢ ਕੇ ਲਿਆਉਣੀਆਂ ਉੱਥੋਂ ਜੰਗਲਾਂ ਵਿੱਚੋਂ ਅਤੇ ਫਿਰ ਉਸ ਨੂੰ ਬਾਲਦੇ ਸੀਗੇ ਅਤੇ ਫਿਰ ਉਸ 'ਤੇ ਰੋ ਰੋਟੀ ਪਕਾਉਂਦੇ ਸੀਗੇ ਆਪਣੀ ਜਾਂ ਜੇਕਰ ਜਿਹੜਾ ਮੱਝਾਂ ਦਾ ਗੋ ਗੋਹਾ ਹੁੰਦਾ ਸੀਗਾ ਉਸ ਦੀਆਂ ਪਾਥੀ ਨੂੰ ਬਣਾ ਕੇ ਉਸ ਦੀ ਪਾਥੀ ਨੂੰ ਅੱਗ ਬਾਲਣ ਲਈ ਯੂਜ ਕੀਤਾ ਜਾਂਦਾ ਸੀਗਾ ਅਤੇ ਉਹ ਸਾਡੇ ਵਾਤਾਵਰਨ ਲਈ ਵੀ ਬਹੁਤ ਵਧੀਆ ਮੰਨੀ ਜਾਂਦੀ ਸੀ ਕਿ ਪਾਥੀ ਜਿਹੜੀ ਹੁੰਦੀ ਸੀਗੀ